ਅੱਜ ਕੱਲ੍ਹ ਸੋਸ਼ਲ ਮੀਡੀਆ ਬਹੁਤ ਹੀ ਵੱਧ ਚੱਲਦਾ ਹੈ ਲੋਕ ਇਸ ਦਾ ਬਹੁਤ ਸਾਰੇ ਇਸਤੇਮਾਲ ਕਰਦੇ ਹਨ ਜਿਵੇਂ ਕਿ ਇਸਟਾਗ੍ਰਾਮ ਅਤੇ ਫੇਸਬੁੱਕ ਹੈ ਉੱਥੇ ਲੋਕ ਆਪਣੀਆਂ ਫੋਟੋਆਂ ਪਾਉਂਦੇ ਹਨ ਲੋਕਾਂ ਨੂੰ ਦਿਖਾਉਂਦੇ ਹਨ ਇਹ ਸਭ ਚੀਜ਼ਾਂ ਇੱਕ ਅਕਾਊਟ ਦੇ ਵਿੱਚ ਬਣਦੀਆਂ ਹਨ ਅਕਾਊਟ ਬਹੁਤ ਤਰ੍ਹਾਂ ਦੇ ਹੁੰਦੇ ਹਨ ਤੁਸੀਂ ਆਪਣਾ ਨਾਮ ਦਾ ਅਕਾਊਟ ਬਣਾ ਕੇ ਉਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ ਉੱਥੇ ਆਪਣੀਆਂ ਫੋਟੋਆਂ ਪਾ ਸਕਦੇ ਹੋ ਅਤੇ ਬਹੁਤ ਕੁਛ ਕਰ ਸਕਦੇ ਹੋ ਅੱਜ ਕੱਲ੍ਹ ਸੋਸ਼ਲ ਮੀਡੀਆ ਬਹੁਤ ਚੱਲਦਾ ਹੈ ਲੋਕ ਇਸ ਦੇ ਬਹੁਤ ਫਾਇਦੇ ਲੈਂਦੇ ਹਨ ਲੋਕ ਘਰ ਬੈਠੇ ਓਨਲਾਈਨ ਬਿਜ਼ਨਸ ਵੀ ਇਸਟਾਗ੍ਰਾਮ ਅਤੇ ਫੇਸਬੁੱਕ ਤੋਂ ਕਰ ਲੈਂਦੇ ਹਨ ਇਹ ਬਹੁਤ ਹੀ ਫਾਇਦੇਮੰਦ ਹੈ ਪਰ ਇਸ ਦਾ ਇੱਕ ਬਹੁਤ ਹੀ ਅਲੱਗ ਜਿਹਾ ਵਿਵਹਾਰ ਵੀ ਹੁੰਦਾ ਹੈ ਇਸ ਵਿੱਚ ਤੁਸੀਂ ਆਪਣੇ ਅਕਾਊਟ ਨੂੰ ਪ੍ਰਾਈਵੇਟ ਕਰ ਸਕਦੇ ਹੋ ਪਬਲਿਕ ਨਹੀਂ ਰੱਖ ਸਕਦੇ ਜੇ ਅਗਰ ਤੁਸੀਂ ਪਬਲਿਕ ਰੱਖਣਾ ਹੈ ਤਾਂ ਤੁਸੀਂ ਉਸ ਵਿੱਚ ਫੋਟੋਆਂ ਚੱਜ ਦੀਆਂ ਪਾਉਣੀਆਂ ਹਨ ਤਾਂ ਕਿ ਕੋਈ ਤੁਹਾਡੇ ਅਕਾਊਟ ਨੂੰ ਹੈਕ ਨਾ ਕਰ ਸਕੇ